ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਲਈ ਇਹ ਅਤੇ ਉਸ ਨੂੰ ਉਤਸਾਹਿਤ ਕਰਨ ਲਈ ਬਹੁਤ ਹੀ ਯਤਨ ਕੀਤੇ ਜਾ ਰਹੇ ਹਨ ਇਹ ਯਤਨ ਸਾਡੀ ਸਰਕਾਰ ਦੁਆਰਾ ਕੀਤੇ ਜਾ ਰਹੇ ਹੈ ਤਾਂ ਲੋਕ ਵੀ ਇਸ ਵਿੱਚ ਵੱਧ ਤੋਂ ਵੱਧ ਜੋ ਹੈ ਵੋ ਸ਼ਾਮਿਲ ਹੋ ਰਹੇ ਹਨ ਕਿਉਂਕਿ ਸਾਡੇ ਪੰਜਾਬ ਦੇ ਜਿੰਨੇ ਵੀ ਸ ਸਰਕਾਰੀ ਦਫਤਰ ਹਨ ਜਾਂ ਸਕੂਲ ਹਨ ਉੱਥੇ ਪੰਜਾਬੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਹਰੇਕ ਕੋਈ ਫਾਰਮ ਜਾਂ ਕੋਈ ਵੀ ਕਾਗਜ਼ ਜੀ ਕਾਰਵਾਈ ਹੈ ਜੋ ਸਾਰੀ ਪੰਜਾਬੀ ਦੇ ਵਿੱਚ ਹੀ ਹੋ ਰਹੀ ਹੈ ਅਤੇ ਲੋਕ ਵੀ ਇਸ ਲਈ ਬਹੁਤ ਖੁਸ਼ ਹਨ ਕਿਉਂਕਿ ਜੋ ਲੋਕ ਪੜ੍ਹੇ ਲਿਖੇ ਨਹੀਂ ਹੁੰਦੇ ਹਨ ਪਰ ਉਹਨਾਂ ਨੂੰ ਆਪਣੀ ਮਾਤ ਭਾਸ਼ਾ ਜੋ ਹੈ ਉਹ ਬਹੁਤ ਹੀ ਚੰਗੀ ਤਰ੍ਹਾਂ ਆਉਂਦੀ ਹੈ ਅਤੇ ਜਿਸ ਕਰਕੇ ਉਹ ਵੀ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਸਾਥ ਦਿੰਦੇ ਹਨ ਅਤੇ ਇਸ ਨੂੰ ਉਤਸਾਹਿਤ ਕਰਨ ਲਈ ਉਹ ਆਪਣੇ ਹਰ ਜੋ ਹੈ ਵੋ ਯਤਨ ਕਰਦੇ ਹਨ ਅਤੇ ਸਾਨੂੰ ਵੀ ਪੰਜਾਬੀ ਨੂੰ ਸੁਰੱਖਿਅਤ ਰੱਖਣ ਲਈ ਅਤੇ ਉਸਨੂੰ ਉਤਸਾਹਿਤ ਕਰਨ ਲਈ ਸਭ ਤੋਂ ਜ਼ਿਆਦਾ ਯਤਨ ਕਰਨੇ ਚਾਹੀਦੇ ਹਨ ਅਤੇ ਜੋ ਸਾਡੀ ਸਰਕਾਰਾਂ ਕਰ ਰਹੀਆਂ ਹਨ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਯੋਗ ਦੇ ਕੇ ਪੰਜਾਬੀ ਨੂੰ ਹੈ ਜੋ ਉਹ ਵੱਧ ਤੋਂ ਵੱਧ ਸਾਰੇ ਦੇਸ਼ ਵਿੱਚ ਹੀ ਜੋ ਹੈ ਇਹ ਚਾਹੁੰਦੇ ਹਨ ਕਿ ਸਾਰੇ ਦੇਸ਼ ਹੀ ਉਸ ਭਾਸ਼ਾ ਨੂੰ ਵਰਤੋਂ ਕਰ ਸਕੇ ਉਸ ਦੀ